ਮੈਂ ਪ੍ਰੇਮ ਸਿੰਘ ਵਾਸੀ ਮਿਰਜਾਪੁਰ ਜ਼ਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਹਾਂ ਦੱਸਣਾ ਚਾਹੁੰਦਾ ਹਾਂ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਾਗਰਿਕਤਾ ਦੀ ਸੁਰੱਖਿਆ ਵਾਸਤੇ ਸਮਾਜ ਵਿੱਚ ਸਰਕਾਰ ਨੂੰ ਕਿਸ ਤਰ੍ਹਾਂ ਦੀ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ ਇਸ ਕਾਨੂੰਨੀ ਪ੍ਰਣਾਲੀ ਨੂੰ ਜੇਕਰ ਸਰਕਾਰ ਸਖਤੀ ਨਾਲ ਲਾਗੂ ਕਰੇ ਤਾਂ ਇਹ ਇਸ ਵਿੱਚ ਕਾਫੀ ਸੁਧਾਰ ਹੋ ਸਕਦਾ ਹੈ ਜਿਸ ਤਰ੍ਹਾਂ ਕਿ ਅੱਜ ਅਸੀਂ ਸਮਾਜ ਵਿੱਚ ਨੌਜਵਾਨਾਂ ਦੀ ਗੱਲ ਕਰੀਏ ਤਾਂ ਉਹ ਕੁਝ ਨੌਜਵਾਨ ਪੜ੍ਹਾਈ ਵਿੱਚ ਅੱਧੀ ਅਧੂਰੀ ਛੱਡ ਕੇ ਗਲਤ ਆਦਤਾਂ ਵੱਲ ਚਲੇ ਜਾਂਦੇ ਹਨ ਜਿਸ ਤਰ੍ਹਾਂ ਕਿ ਦੀਆਂ ਗੇਮਾਂ ਖੇਡਦੇ ਤਰ੍ਹਾਂ ਤਰ੍ਹਾਂ ਦੀਆਂ ਕੰਮ ਕਰਦੇ ਮੋਟਰਸਾਈਕਲ ਖਰੀਦਦੇ ਅਤੇ ਉਸ ਦੇ ਉੱਤੇ ਸਟੰਟ ਕਰਦੇ ਜਾਂ ਹੋਰ ਦੋ ਚਾਰ ਜਣੇ ਰਲ ਕੇ ਨਸ਼ੇ ਕਰ ਕਰਕੇ ਆਦਿ ਜਿਹੜੇ ਕਿ ਸਮਾਜ ਵਿੱਚ ਪ੍ਰਚੱਲਿਤ ਇਹਨਾਂ ਨੂੰ ਨੇ ਕੰਮ ਕੀ ਕੀਤਾ ਹਨ ਹਨ ਉਨ੍ਹਾਂ ਦਾ ਸੁਧਾਰ ਹੋਣਾ ਬੜਾ ਹੀ ਜ਼ਰੂਰੀ ਹੈ ਕਿਉਂਕਿ ਜੇਕਰ ਅਸੀਂ ਨਾਗਰਿਕਤਾ ਦੀ ਸੁਰੱਖਿਆ ਕਰਾਂਗੇ ਤਾਂ ਹੀ ਸਾਡਾ ਦੇਸ਼ ਸੁਰਕਸ਼ਿਤ ਰਹੇਗਾ ਅੱਜ ਦੇਸ਼ ਵਿੱਚ ਵੱਧ ਰਹੇ ਅਦਾ ਅਪਰਾਧ ਦਰ ਬਾਰੇ ਹੀ ਬਹੁਤ